ਮੈਂ ਅਧਿਆਪਕ ਹਾਂ ਅਤੇ ਮੈਂ ਆਪਣੇ ਅਧਿਆਪਕ ਦੇ ਪੇਸ਼ੇ ਨੂੰ ਮੁੱਖ ਰੱਖਦੇ ਹੋਏ ਰੋਜ਼ ਹੀ ਵਰਪਾਲ ਜਾਂਦੀ ਹਾਂ ਮੈਂ ਰੋਜ਼ ਹੀ ਉਹਦਾ ਦੌਰਾ ਕਰਦੀ ਹਾਂ ਹਫ਼ਤੇ ਦੇ ਵਿੱਚ ਇੱਕ ਐਤਵਾਰ ਦੀ ਹੀ ਛੁੱਟੀ ਹੁੰਦੀ ਹੈ ਜਦੋਂਕਿ ਮੈਂ ਉਹਦੇ ਵਿੱਚ ਉੱਥੇ ਉਸ ਕਸਬੇ ਦੇ ਵਿੱਚ ਨਹੀਂ ਜਾਂਦੀ ਨਹੀਂ ਅਤੇ ਰੋਜ਼ਾਨਾ ਹੀ ਮੈਂ ਤਾਂ ਪੜ੍ਹਾਉਣ ਵਾਸਤੇ ਉਸ ਕਸਬੇ ਵਿੱਚ ਜਾਂਦੀ ਹਾਂ ਤਾਂ ਦੇਖਦੀ ਹਾਂ ਕਿ ਉੱਥੇ ਦੀਆਂ ਸੜਕਾਂ ਦੀ ਹਾਲਤ ਕਿੰਨੀ ਖ਼ਰਾਬ ਹੈ ਅਤੇ ਮੈਂ ਉਹ ਉਹਦੇ ਉਹਨੂੰ ਪੂਰਾ ਕਰਨ ਵਾਸਤੇ ਉੱਥੇ ਦੀ ਘਰਾਂ ਦੇ ਵਿੱਚ ਵੀ ਜਾਂਦੀ ਹਾਂ ਉਹ ਘਰਾਂ ਦੇ ਵਿੱਚ ਫੈਸਿਲਿਟੀਆ ਹੈਗੀਆਂ ਹੈ ਪਰ ਜਿਹੜੀ ਬਾਹਰ ਸੜਕ ਖਸਤਾ ਹੈ ਜੇ ਰਾਤ ਦੇ ਰਾਤੀ ਕਿਸੇ ਨੂੰ ਲੋੜ ਪੈਣ 'ਤੇ ਦਵਾਈ ਨਹੀਂ ਮਿਲ ਸਕਦੀ ਇਸ ਕਰਕੇ ਮੈਂ ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਉਸ ਨੇੜਲੇ ਕਸਬਿਆਂ ਦੇ ਵਿੱਚ ਜਾਂਦੀ ਹਾਂ ਤਾਂ ਕਿ ਮੈਨੂੰ ਪਤਾ ਲੱਗੇ ਕਿ ਸ਼ਹਿਰ ਦਾ ਅਤੇ ਕਸਬੇ ਅਤੇ ਪਿੰਡਾਂ ਦੇ ਵਿੱਚ ਕੀ ਅੰਤਰ ਹੈ ਤਾਂ ਕਿ ਅਸੀਂ ਉਹਨਾਂ ਦੇ ਅੰਤਰ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਲੋੜਵੰਦਾਂ ਦੀ ਲੋ ਜ਼ਰੂਰਤ ਨੂੰ ਪੂਰਾ ਕਰ ਸਕੀਏ ਅਸੀਂ ਮੈਂ ਨੇੜਲੇ ਅ ਕਸਬਿਆਂ ਦੇ ਵਿੱਚ ਤਾਂ ਕਰਕੇ ਜਾਂਦੀ ਕਿ ਇੱਕ ਪਿੰਡ ਦੇ ਵਿੱਚ ਕੀ ਹੈ ਅਤੇ ਦੂਜੇ ਪਿੰਡ ਦੇ ਵਿੱਚ ਕੀ ਹੈ ਅਤੇ ਸ਼ਹਿਰਾਂ ਦੇ ਮੁਕਾਬਲੇ ਕਸਬਿਆਂ ਦੇ ਵਿੱਚ ਕੀ ਸਹੂਲਤਾਂ ਨਹੀਂ ਹੈਗੀਆ ਅਸੀਂ ਉਹ ਸਹੂਲਤਾਂ ਅਸੀਂ ਆਪਣੀ ਪੰਜਾਬ ਸਰਕਾਰ ਨੂੰ ਕਹਿ ਕੇ ਉਹ ਸਹੂਲਤਾਂ ਜਿਹੜੀਆਂ ਹੈ ਉਹ ਪੂਰੀਆਂ ਕਰਵਾਈਏ ਤਾਂ ਕਿ ਉਹ ਕਸਬਿਆਂ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਉਹ ਸਹੂਲਤਾਂ ਦਾ ਫ਼ਾਇਦਾ ਮਿਲ ਸਕੇ ਜੋ ਕਿ ਸ਼ਹਿਰ ਦੇ ਲੋਕਾਂ ਨੂੰ ਮਿਲਦਾ ਹੈ ਇਸ ਕਰਕੇ ਮੈਂ ਨੇੜਲੇ ਕਸਬਿਆਂ ਅਤੇ ਪਿੰਡਾਂ ਦੇ ਵਿੱਚ ਪੜ੍ਹਾਉਣ ਜਾਂਦੀ ਹਾਂ ਅਤੇ ਨਾਲੇ ਉਹਨਾਂ ਦੇ ਦੌਰਾ ਵੀ ਕਰਦੀ ਹਾਂ ਘੁੰਮ ਫਿਰ ਕੇ ਦੇਖਦੀ ਹਾਂ ਅਤੇ ਕਿੱਥੇ ਕੀ ਡਿਸਪੈਂਸਰੀ ਬਣੀ ਹੋਈ ਹੈ ਜਾਂ ਹਸਪਤਾਲ ਬਣੇ ਹੋਏ ਹਨ ਜਾਂ ਕੁਛ ਹੋਰ ਬੈਂਕਾਂ ਦੀਆਂ ਸੁਵਿਧਾਵਾਂ ਮਿਲਦੀਆਂ ਹਨ ਅਤੇ ਪਿੰਡਾਂ ਅਤੇ ਸ਼ਹਿਰਾਂ ਦਾ ਕੀ ਫ਼ਰਕ ਹੈ ਇਸ ਉਦੇਸ਼ ਲਈ ਮੈਂ ਪਿੰਡਾਂ ਦਾ ਦੌਰਾ ਕਰਦੀ ਹਾਂ ਮੈਂ ਪਿੰਡਾਂ ਦਾ ਦੌਰਾ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਹੀ ਕਰਦੀ ਹਾਂ